ਹੈਲੋ ਹਾਂਜੀ ਮੈਂ ਗੁਰਦੀਪ ਸਿੰਘ ਮੋਹਾਲੀ ਤੋਂ ਗੱਲ ਕਰ ਰਿਹਾ ਜੀ ਮੈਂ ਆਪਣੇ ਪਰਿਵਾਰ ਸਮੇਤ ਸ਼ਿਮਲੇ ਜਾਣ ਲਈ ਆਪ ਦੀ ਵੈਬਸਾਈਟ ਤੋਂ ਗੱਡੀ ਬੁੱਕ ਕਰਵਾਈ ਸੀ ਕਿਉਂਕਿ ਮੇਰਾ ਅਤੇ ਮੇਰੇ ਪਰਿਵਾਰ ਦਾ ਸ਼ਿਮਲੇ ਜਾਣ ਦਾ ਪ੍ਰੋਗਰਾਮ ਸੀ ਮੈਂ ਗੱਡੀ ਦੀ ਪੇਸ਼ਗੀ ਦਾ ਭੁਗਤਾਨ ਪਹਿਲਾਂ ਹੀ ਕਰ ਚੁੱਕਾ ਹਾਂ ਇਸ ਲਈ ਮੈਨੂੰ ਆਪ ਦੀ ਵੈਬਸਾਈਟ ਤੋਂ ਡਰਾਈਵਰ ਸੁਰਿੰਦਰ ਸਿੰਘ ਦਾ ਫੋਨ ਨੰਬਰ ਪ੍ਰਾਪਤ ਹੋਇਆ ਪਰੰਤੂ ਜਦੋਂ ਮੈਂ ਡਰਾਈਵਰ ਸੁਰਿੰਦਰ ਸਿੰਘ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੀ ਕਾਲ ਨਹੀਂ ਚੁੱਕ ਰਿਹਾ ਸੀ ਮੈਂ ਸ਼ਿਮਲੇ ਹੋਟਲ ਬੁੱਕ ਕੀਤਾ ਹੈ ਅਗਰ ਮੈਂ ਪਰਿਵਾਰ ਸਮੇਤ ਸਮੇਂ ਸਿਰ ਨਹੀਂ ਪਹੁੰਚਿਆ ਤਾਂ ਮੇਰੀ ਹੋਟਲ ਦੀ ਬੁਕਿੰਗ ਰੱਦ ਹੋ ਜਾਵੇਗੀ ਅਤੇ ਮੇਰਾ ਨੁਕਸਾਨ ਹੋਵੇਗਾ ਮੈਂ ਸਵੇਰ ਤੋਂ ਹੀ ਉਸ ਨੂੰ ਫੋਨ ਕਰ ਰਿਹਾ ਹਾਂ ਪਰ ਉਹ ਮੇਰੀ ਪਹੁੰਚ ਤੋਂ ਬਾਹਰ ਹੈ ਇਸ ਲਈ ਮੈਂ ਆਪ ਦੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦਾ ਹਾਂ ਕਿ ਮੇਰੀ ਇਹ ਗੱਲ ਸਰਦਾਰ ਸੁਰਿੰਦਰ ਸਿੰਘ ਤੱਕ ਪਹੁੰਚਾਈ ਜਾਵੇ ਜਾਂ ਕੋਈ ਮੈਨੂੰ ਕੋਈ ਦੂਜਾ ਰਾਹ ਦੱਸਿਆ ਜਾਵੇ ਜਿਸ ਨਾਲ ਕਿ ਮੈਂ ਸੈਰ ਸਪਾਟੇ 'ਤੇ ਆਪਣੇ ਪਰਿਵਾਰ ਸਮੇਤ ਸਹੀ ਸਮੇਂ ਸਿਰ ਪਹੁੰਚ ਸਕਾਂ ਧੰਨਵਾਦ